ਮੈਂ ਹਮੇਸ਼ਾ ਇਹੀ ਸੋਚਦਾ ਰਹਿੰਦਾ ਹਾਂ ਕਿਉਂਕਿ ਸਾਰੀ ਉਮਰ ਬੰਦਾ ਸਿੱਖਦਾ ਹੀ ਹੈ ਜੇ ਤੁਸੀਂ ਕਹੋਂਗੇ ਬਹੁਤ ਤਕੜੇ ਤੁਸੀਂ ਵਿਦਵਾਨ ਬਣ ਗਏ ਹੋ ਜਾਂ ਲੇਖਕ ਬਣ ਗਏ ਉਹ ਮੈਨੂੰ ਇਹ ਚੀਜ਼ਾਂ ਨਹੀਂ ਹੈਗੀਆਂ ਫਿੱਟ ਅਤੇ ਇਸ ਕਰਕੇ ਤਕਰੀਬਨ ਸਾਰੇ ਬੰਦੇ ਸਾਰੀ ਉਮਰ ਸਿੱਖਦੇ ਹੀ ਰਹਿੰਦੇ ਹਨ ਅਤੇ ਵੱਖਰਾ ਤਾਂ ਕੋਈ ਖਾਸ ਨਹੀਂ ਕਹਿ ਸਕਦੇ ਪਰ ਕਈ ਕੁਝ ਥੋੜ੍ਹਾ ਬਹੁਤਾ ਲਿਖ ਕੇ ਆਪਣੇ ਆਪ ਨੂੰ ਬਹੁਤ ਵੱਡੇ ਲੇਖਕ ਸਮਝਣ ਲੱਗ ਜਾਂਦੇ ਹਨ ਅਤੇ ਮੈਂ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਮੈਂ ਜੋ ਵੀ ਲਿਖਾਂ ਜੋ ਵੀ ਲਿਖਤ ਹੋਵੇ ਉਸਨੂੰ ਕੁਝ ਨਾ ਕੁਝ ਸੁਧਾਰਨ ਦੀ ਕੋਸ਼ਿਸ਼ ਕੀ ਕਰਾਂ ਜਿਵੇਂ ਕਿ ਭਾਸ਼ਾ ਦੇ ਅੱਖਰ ਕਿੱਥੇ ਕੰਨੇ ਬਿੰਦੀਆਂ ਜਾਂ ਕੁਝ ਇੱਦਾਂ ਦੀਆਂ ਚੀਜ਼ਾਂ ਜੋ ਪੰਜਾਬੀ ਦੇ ਠੇਠ ਸ਼ਬਦ ਮੰਨੇ ਜਾਂਦੇ ਹਨ ਉਹ ਕੁਝ ਪਾਏ ਜਾਣ ਉਹ ਜਿੱਥੋਂ ਵੀ ਕਿਤੋਂ ਮੈਨੂੰ ਕੋਈ ਇੱਦਾਂ ਦੀ ਚੀਜ਼ ਮਿਲਦੀ ਹੈ ਜਾਂ ਕਿਸੇ ਤੋਂ ਸੁਣਦਾ ਹਾਂ ਮੈਂ ਉਹ ਹਮੇਸ਼ਾ ਨੋਟ ਕਰ ਲੈਂਦਾ ਹਾਂ ਅਤੇ ਜਦੋਂ ਵੀ ਕਿਤੇ ਕੋਈ ਅੱਗੇ ਕੋਈ ਲੇਖ ਜਾਂ ਕੋਈ ਲਿਖਤ ਲਿਖਣੀ ਜਾਂ ਕਵਿਤਾ ਜਾਂ ਕੋਈ ਗੀਤ ਲਿਖਣਾ ਹੁੰਦਾ ਹੈ ਤਾਂ ਫਿਰ ਮੈਂ ਉਹ ਸ਼ਬਦਾਂ ਦੀ ਉੱਥੇ ਜ਼ਰੂਰ ਵਰਤੋਂ ਕਰਦਾ ਰਹਿੰਦਾ ਹਾਂ ਜਿਸ ਦਾ ਮੈਨੂੰ ਬਹੁਤ ਵੱਡਾ ਲਾਭ ਵੀ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਸ਼ਬਦ ਅਜਿਹੇ ਹਨ ਜਿਨਾਂ ਬਾਰੇ ਤੁਹਾਨੂੰ ਨਹੀਂ ਪਤਾ ਹੁੰਦਾ ਫਿਰ ਵੀ ਕਿਤੋਂ ਨਾ ਕਿਤੋਂ ਸਿੱਖ ਲੈਣਾ ਕੋਈ ਮਾੜੀ ਗੱਲ ਨਹੀਂ